ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਇਨਸਾਨ ਦੇ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜਿਸ ਦੇ ਨਾਲ਼ ਬਹੁਤ ਸਾਰੀ ਮਹਿੰਗਾਈ ਵੱਧ ਰਹੀ ਹੈ ਅਤੇ ਆਮ ਆਦਮੀ ਉਸਨੂੰ ਅਫੋਰਡ ਨਹੀਂ ਕਰ ਸਕਦਾ ਜਿਸ ਦੇ ਨਾਲ਼ ਐੱਲਪੀਜੀ ਵੀ ਬਹੁਤ ਮਹਿੰਗੀ ਹੋ ਰਹੀ ਹੈ ਜੋ ਕਿ ਆਮ ਆਦਮੀ ਉਸਨੂੰ ਨਹੀਂ ਅਫੋਰਡ ਕਰ ਸਕਦਾ ਅਤੇ ਖਾਣਾ ਬਣਾਉਣ ਲਈ ਉਹ ਲੱਕੜੀਆਂ ਦਾ ਇਸਤੇਮਾਲ ਕਰ ਰਿਹਾ ਹੈ ਲੱਕੜੀਆਂ ਦੇ ਇਸਤੇਮਾਲ ਕਰਨ ਦੇ ਨਾਲ਼ ਜੋ ਮਤਲਬ ਕਾਰਬਨ ਡਾਈਆਕਸਾਈਡ ਜਾਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ਉਹ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਰਹੀ ਮਹਿੰਗਾਈ ਨੂੰ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਉਹ ਕੰਟਰੋਲ ਵਿੱਚ ਕਰੇ ਤਾਂ ਜੋ ਕਿ ਮਹਿੰਗਾਈ ਜ਼ਿਆਦਾ ਨਾ ਵਧੇ ਅਤੇ ਆਮ ਆਦਮੀ ਦਾ ਜੀਵਨ ਸੁਖਾਲਾ ਹੋਵੇ ਅਤੇ ਵਾਤਾਵਰਨ ਵਿੱਚ ਵੀ ਕੋਈ ਪ੍ਰਦੂਸ਼ਣ ਨਾ ਫੈਲੇ